ਇਸ ਖੇਤਰ ਵਿੱਚ ਅਕਸਰ ਮੈਂ ਜ਼ਿਆਦਾਤਰ ਕਬੂਤਰ ਅਤੇ ਚਿੜੀਆਂ ਹੀ ਦੇਖਦਾ ਹਾਂ ਪਰ ਮੈਨੂੰ ਬੋ ਮੋਰ ਬਹੁਤ ਹੀ ਵਧੀਆ ਲੱਗਦਾ ਹੈ ਜਦੋਂ ਵੀ ਬਾਰਿਸ਼ ਹੁੰਦੀ ਹੈ ਤਾਂ ਮੋਰ ਆਪਣੇ ਪੰਖ ਫੈਲਾ ਕੇ ਨੱਚਦਾ ਹੈ ਜੋ ਕਿ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਅਤੇ ਮੋਰ ਇੱਕ ਬਹੁਤ ਹੀ ਖੂਬਸੂਰਤ ਪੰਛੀ ਹੈ ਬਾਕੀ ਪੰਛੀ ਵੀ ਬਹੁਤ ਵਧੀਆ ਹੁੰਦੇ ਹਨ ਪਰ ਮੇਰੀ ਪਰਸਨਲ ਚੋਇਸ ਮੋਰ ਹੈ ਕਿਉਂਕਿ ਮੋਰ ਦੇ ਖੰਭ ਵੀ ਬਹੁਤ ਵਧੀਆ ਹੁੰਦੇ ਹਨ ਜਦੋਂ ਇਹ ਆਪਣੇ ਖੰਭ ਖਿਲਾਰਦਾ ਹੈ ਤਾਂ ਬਹੁਤ ਵਧੀਆ ਲੱਗਦਾ ਹੈ ਅਤੇ ਪੈਲਾਂ ਪਾਉਂਦਾ ਹੈ ਖਾਸ ਕਰਕੇ ਮੀਂਹ ਦੇ ਮੌਸਮ ਵਿੱਚ ਅਤੇ ਸਾਉਣ ਦੇ ਮਹੀਨੇ ਵਿੱਚ ਮੋਰ ਬਹੁਤ ਪੈਲਾਂ ਪਾਉਂਦੇ ਹਨ ਕਿਉਂਕਿ ਮੋਰ ਮੀਂਹ ਦੇ ਮੌਸਮ ਵਿੱਚ ਹੀ ਨੱਚਦੇ ਹਨ ਮੋਰ ਅੱਜ ਕੱਲ੍ਹ ਬਹੁਤ ਹੀ ਘੱਟ ਗਏ ਹਨ ਪਰ ਫਿਰ ਵੀ ਜਿਸ ਜਗ੍ਹਾਵਾਂ 'ਤੇ ਹਨ ਮੈਨੂੰ ਮੋਰ ਬਹੁਤ ਖੂਬਸੂਰਤ ਲੱਗਦੇ ਹਨ ਇਹ ਸਾਰੇ ਪਕਛੀਆਂ ਤੋਂ ਬਹੁਤ ਹੀ ਵੱਖਰੇ ਤਰ੍ਹਾਂ ਦੇ ਹਨ ਮੋਰ ਬਹੁਤ ਹੀ ਖੂਬਸੂਰਤ ਪਕਛੀ ਹੈ ਮੇਰੇ ਹਿਸਾਬ ਨਾਲ ਦੁਨੀਆਂ ਦਾ ਸਭ ਤੋਂ ਕੋਈ ਖੂਬਸੂਰਤ ਪਕਛੀ ਹੋਵੇਗਾ ਤਾਂ ਮੋਰ ਹੀ ਹੋਵੇਗਾ ਮੇਰੀ ਪਰਸਨਲ ਚੋਇਸ ਮੋਰ ਹੈ